ਹਾਂ ਮੈਂ ਗਣੇਸ਼ ਜੀ ਅਤੇ ਲਕਸ਼ਮੀ ਜੀ ਦੀ ਮੂਰਤੀ ਬਣਾਈ ਹੈ ਦਿਵਾਲੀ ਦੇ ਮੌਕੇ 'ਤੇ ਕਿਉਂਕਿ ਮੈਨੂੰ ਬਹੁਤ ਵਧੀਆ ਲੱਗਦਾ ਹੈ ਜਦੋਂ ਹੱਥ ਨਾਲ ਬਣਾਈ ਹੋਈ ਮੂਰਤੀ ਦੀ ਪੂਜਾ ਹੁੰਦੀ ਹੈ ਮੈਂ ਇਹ ਮੂਰਤੀ ਆਪਣੇ ਪਰਿਵਾਰ ਅਤੇ ਗੁਆਂਡੀਆਂ ਲਈ ਬਣਾਈ ਸੀ ਅਤੇ ਉਹਨਾਂ ਨੂੰ ਤੋਹਫੇ ਵਿੱਚ ਦਿੱਤੀਆਂ ਸੀ ਅਤੇ ਉਹਨਾਂ ਨੇ ਉਹ ਮੂਰਤੀਆਂ ਆਪਣੇ ਮੰਦਰ ਵਿੱਚ ਵੀ ਰੱਖੀਆਂ ਸਨ ਅਤੇ ਉਹਨਾਂ ਦੀ ਪੂਜਾ ਵੀ ਕੀਤੀ ਸੀ ਮੂਰਤੀਆਂ ਬਣਾਉਣ ਦਾ ਮੈਨੂੰ ਬਹੁਤ ਸ਼ੌਕ ਹੈ ਕਿਉਂਕਿ ਇਹਨਾਂ ਨਾਲ ਮੈਨੂੰ ਬਹੁਤ ਜ਼ਿਆਦਾ ਸਕੂਨ ਮਿਲਦਾ ਹੈ ਅਤੇ ਜਦੋਂ ਇਹਨਾਂ ਮੂਰਤੀਆਂ ਦੀ ਪੂਜਾ ਹੁੰਦੀ ਹੈ ਤਾਂ ਇੱਕ ਅਲੱਗ ਹੀ ਲੈਵਲ ਦਾ ਸਕੂਨ ਮਿਲਦਾ ਹੈ ਕਿਉਂਕਿ ਜਿਹੜੀਆਂ ਹੱਥ ਨਾਲ ਬਣਾਈਆਂ ਮੂਰਤੀਆਂ ਹੁੰਦੀਆਂ ਹਨ ਉਹਨਾਂ ਨੂੰ ਅਸੀਂ ਡਿਸਪੋਜਲ ਕਰਨ ਲਈ ਵੀ ਬਹੁਤ ਜ਼ਿਆਦਾ ਐਫਰਟਸ ਨਹੀਂ ਲਗਾ ਸਕਦੇ ਅਤੇ ਜੋ ਮੂਰਤੀਆਂ ਅਸੀਂ ਮਾਰਕਿਟ ਤੋਂ ਲੈਂਦੇ ਹਾਂ ਉਹ ਬਹੁਤ ਜ਼ਿਆਦਾ ਵੇਸਟੇਜ਼ ਹੁੰਦੀ ਆ ਉਹਨਾਂ ਦੀ ਕਿਉਂਕਿ ਜਿੱਦਾਂ ਅਸੀਂ ਦੇਖਦੇ ਹੀ ਹਾਂ ਲੋਕ ਮੂਰਤੀ ਦਾ ਵਿਸਰਜਨ ਕਰਦੇ ਹਨ ਅਤੇ ਸਾਰਾ ਸਮੁੰਦਰ ਭਰਿਆ ਹੁੰਦਾ ਹੈ ਮੂਰਤੀਆਂ ਨਾਲ ਜਿਹਦੇ ਨਾਲ ਬਹੁਤ ਜ਼ਿਆਦਾ ਪੋਲਿਊਸ਼ਨ ਵੀ ਹੁੰਦਾ ਹੈ ਅਤੇ ਵੋਟਰ ਪੋਲਿਊਸ਼ਨ ਨਾਲ ਬਹੁਤ ਸਾਰੇ ਜੀਵ ਜੰਤੂ ਵੀ ਮਰ ਜਾਂਦੇ ਹਨ ਇਹਨਾਂ ਮੂਰਤੀਆਂ ਨੇ ਬਹੁਤ ਜ਼ਿਆਦਾ ਡਿਸਰਿਸਪੈਕਟ ਵੀ ਹੁੰਦੀ ਹੈ ਜੋ ਮੂਰਤੀਆਂ ਅਸੀਂ ਬਾਹਰੋਂ ਲੈਂਦੇ ਹਾਂ ਅਤੇ ਜੋ ਘਰ ਬਣਾਵਾਂਗੇ ਉਹ ਅਸੀਂ ਉਸ ਮਟੀਰੀਅਲ ਨਾਲ ਬਣਾਉਂਦੇ ਹਾਂ ਜੋ ਮਟੀਰੀਅਲ ਡਿਸਪੋਜ ਇਜੀਲੀ ਹੋ ਜਾਵੇ